ਹਾਂਜੀ ਰਮਨ ਜੀ ਬੋਲਦੇ ਹੋ ਜੀ ਹਾਂਜੀ ਮੈਂ ਰੋਪੜ ਤੋਂ ਗੁਰਪ੍ਰੀਤ ਬੋਲਦੀ ਹਾਂ ਜੀ ਤੁਹਾਡੇ ਬ੍ਰਦਰ ਤੋਂ ਲਿਆ ਸੀ ਨੰਬਰ ਅਤੇ ਸਾਨੂੰ ਟ੍ਰੈਵਲਰ ਗੱਡੀ ਚਾਹੀਦੀ ਹੈ ਜੀ ਟੂਰ ਵਾਸਤੇ ਅਸੀਂ ਹੈਗੇ ਗਲੀ ਦੇ ਜੇ ਪੱਚੀ ਕੁ ਬੰਦੇ ਹੋ ਜਾਣਗੇ ਜੀ ਹਾਂਜੀ ਹਾਂਜੀ ਅਸੀਂ ਹਰਿਮੰਦਰ ਸਾਹਿਬ ਜਾਣਾ ਹੈ ਜੀ ਅੰਬਰਸਰ ਅਤੇ ਹੋਰ ਵੀ ਗੁਰਦੁਆਰਾ ਸਾਹਿਬ ਦਰਸਨ ਕਰਨੇ ਨੇ ਵਧੀਆ ਨਵੀਂ ਗੱਡੀ ਹੋਵੇ ਅਤੇ ਖਾਣਾ ਪੀਣਾ ਸਾਡਾ ਆਪਣਾ ਹੀ ਹੋਵੇਗਾ ਹਾਂਜੀ ਬਾਕੀ ਦੱਸ ਦਿਓ ਜੀ ਇੱਥੇ ਓ ਰੋਪੜ ਹਵੇਲੀ ਹੈ ਜੀ ਬੜੀ ਹਵੇਲੀ ਅਤੇ ਮੰਦਰ ਕੋਲ ਆ ਜਿਓ ਮੰਦਰ ਕੋਲ ਹੈ ਜੀ ਕ੍ਰਿਸ਼ਨਾ ਮੰਦਰ ਕੋਲ ਹਾਂਜੀ ਹਾਂਜੀ ਕ੍ਰਿਸ਼ਨਾ ਮੰਦਰ ਕੋਲ ਆ ਜਿਓ ਠੀਕ ਹੈ ਠੀਕ ਹੈ